ਟਿਊਬਵੈੱਲ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਧਰਤੀ ਦੇ ਵਿੱਚ ਲਗਭਗ ਤਿੰਨ ਸੋ ਤੋਂ ਚਾਰ ਸੌ ਫੁੱਟ ਦੇ ਤਕਰੀਬਨ ਬੋਰ ਕੀਤਾ ਜਾਂਦਾ ਹੈ ਜੋ ਕਿ ਬੋਰਿੰਗ ਮਸ਼ੀਨ ਦੇ ਨਾਲ ਕੀਤਾ ਜਾਂਦਾ ਹੈ ਫਿਰ ਉਸ ਦੇ ਵਿੱਚ ਪਲਾਸਟਿਕ ਦੇ ਪਾਈਪ ਜਿਸ ਨੂੰ ਡਿਲੀਵਰੀ ਕਿਹਾ ਜਾਂਦਾ ਹੈ ਉਹ ਨੀਚੇ ਇੰਸਟੋਲ ਕੀਤੀ ਜਾਂਦੀ ਹੈ ਫਿਰ ਉਸ ਦੇ ਵਿੱਚ ਇਲੈਕਟ੍ਰਿਕ ਮੋਟਰ ਜਿਸ ਨੂੰ ਪੰਪ ਵੀ ਕਿਹਾ ਜਾਂਦਾ ਹੈ ਉਹ ਪਾਇਆ ਜਾਂਦਾ ਹੈ ਅਤੇ ਉਸ ਨੂੰ ਡਿਲੀਵਰੀ ਵਾਲੇ ਪਾਈਪ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਂਦਾ ਹੈ ਜਿਸ ਨਾਲ ਮੀਟਰ ਬਕਸੇ ਤੋਂ ਸਵਿੱਚ ਦੱਬ ਕੇ ਆਪਾਂ ਟਿਊਬਵੈੱਲ ਚਲਾ ਸਕਦੇ ਹਾਂ ਅਤੇ ਉਹ ਸਾਨੂੰ ਪਾਣੀ ਦਿੰਦਾ ਹੈ ਫਿਲਹਾਲ ਦੇ ਦਿਨਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਵੀ ਖੂਹ ਚੱਲਦਾ ਨਹੀਂ ਹੈ ਹਾਂ ਹਾਲਾਂਕਿ ਪੁਰਾਣੇ ਖੂਹ ਹਨ ਪਰ ਉਹਨਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਸਾਡੇ ਪਿੰਡ ਜੋ ਵੀ ਪਾਣੀ ਆਉਂਦਾ ਹੈ ਉਹ ਟਿਊਬਵੈੱਲਾਂ ਦੇ ਰਾਹੀਂ ਹੀ ਆਉਂਦਾ ਹੈ ਅਤੇ ਅਸੀਂ ਪੀਣ ਦੇ ਲਈ ਅਤੇ ਹੋਰ ਕੰਮਾਂ ਦੇ ਲਈ ਟਿਊਬਵੈੱਲ ਤੋਂ ਹੀ ਪਾਣੀ ਵਰਤਦੇ ਹਾਂ